ਖੇਡਾਂ 'ਚ ਇੱਕ ਕੋਚ ਦੀ ਬੜੀ ਮਹੱਤਤਾ ਹੁੰਦੀ ਹੈ ਉਹਦਾ ਕਾਰਨ ਇਹ ਹੈ ਕਿ ਕੋਚ ਦੇ ਕਹਿਣ 'ਤੇ ਹੀ ਬੱਚੇ ਪ੍ਰੋਪਰ ਟਰੇਨ ਹੁੰਦੇ ਨੇ ਅਤੇ ਉਹ ਆਪਣਾ ਕੰਮ ਕਰਦੇ ਨੇ ਬੱਚਿਆਂ ਨੂੰ ਇੱਕ ਕੋਚ ਹੀ ਗਾਈਡ ਕਰਦਾ ਵੀ ਤੁਸੀਂ ਕਿੱਦਾਂ ਖੇਡਣਾ ਅਤੇ ਤੁਹਾਡੀ ਕੀ ਰਣਨੀਤੀ ਹੋਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਅੱਗੇ ਜਦੋਂ ਉਹ ਗੇਮ ਖੇਡਣ ਜਾਂਦੇ ਨੇ ਅਤੇ ਪਿੱਛੋਂ ਕੋਚ ਜੋ ਸਮਝਾਇਆ ਜਾਂਦਾ ਹੈ ਕੋਚ ਦੀਆਂ ਗੱਲਾਂ ਦਿਮਾਗ 'ਚ ਰੱਖ ਕੇ ਹੀ ਬੱਚੇ ਖੇਡਦੇ ਨੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਅਨੁਭਵੀ ਖਿਡਾਰੀਆਂ ਨੂੰ ਹੀ ਕੋਚ ਬਣਨਾ ਚਾਹੀਦਾ ਹੈ ਕਿਉਂਕਿ ਉਹਨਾਂ ਨੇ ਉਹ ਚੀਜ਼ਾਂ ਆਪਣੇ ਵੱਲ ਫੇਸ ਕੀਤੀਆਂ ਹੁੰਦੀਆਂ ਵੀ ਕਿੱਦਾਂ ਅਸੀਂ ਖੇਡਦੇ ਸੀਗੇ ਵੀ ਉਸ ਟਾਈਮ ਮੈਨੂੰ ਕੀ ਔਖ ਆਈ ਸੀਗੀ ਅਤੇ ਮੈਨੂੰ ਕੀ ਹੋਰ ਕਰਨਾ ਚਾਹੀਦਾ ਅੱਗੇ ਗੇਮ ਬਣਾਉਣ ਵਾਸਤੇ ਅਤੇ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਹਾਂ ਵੀ ਜਿਹੜੇ ਅਨੁਭਵੀ ਖਿਡਾਰੀ ਹੈ ਉਹਨਾਂ ਨੂੰ ਹੀ ਕੋਚ ਬਣਾਉਣਾ ਜਾਣਾ ਚਾਹੀਦਾ ਹੈ